ਡਰਾਇੰਗ ਮੈਨੂੰ ਛੋਟੇ ਹੁੰਦੇ ਤੋਂ ਹੀ ਬਹੁਤ ਪਸੰਦ ਸੀ ਫਿਰ ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਅੱਠਵੀਂ ਕਲਾਸ 'ਚ ਸੀ ਤਾਂ ਮੇਰੇ ਪ੍ਰਿੰਸੀਪਲ ਸਾਹਿਬ ਨੇ ਸਾਡਾ ਇੱਕ ਡਰਾਇੰਗ ਦਾ ਲੈਕਚਰ ਲਗਵਾਇਆ ਜਿਹਦੇ ਵਿੱਚ ਮੈਨੂੰ ਡਰਾਇੰਗ ਬਹੁਤ ਹੀ ਜ਼ਿਆਦਾ ਪਸੰਦ ਸੀ ਮੈੈਂ ਤਾਂ ਫਿਰ ਉਸ ਤੋਂ ਬਾਅਦ ਸਾਡੀਆਂ ਡਰਾਇੰਗ ਦੀਆਂ ਕਲਾਸਿਜ਼ ਲੱਗਦੀਆਂ ਗਈਆਂ ਅਤੇ ਟੀਚਰ ਸਾਨੂੰ ਬਹੁਤ ਹੀ ਵਧੀਆ ਵਧੀਆ ਸਿਖਾਉਂਦੇ ਗਏ ਹੌਲੀ ਹੌਲੀ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਫੰਕਸ਼ਨਜ਼ ਹੋਣ ਲੱਗ ਗਏ ਜਿਹਦੇ ਵਿੱਚ ਡਰਾਇੰਗ ਦਾ ਕੰਪੀਟੀਸ਼ਨ ਹੁੰਦਾ ਸੀ ਅਤੇ ਉਹ ਕੰਪੀਟੀਸ਼ਨ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੀ ਸੀ ਫਿਰ ਉਸ ਤੋਂ ਬਾਅਦ ਇੱਕ ਵਾਰ ਅਸੀਂ ਮਿਊਂਜ਼ੀਅਮ ਗਏ ਜਿੱਥੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਗਿਆ ਅਤੇ ਉੱਥੇ ਸਾਡਾ ਇੱਕ ਡਰਾਇੰਗ ਕੰਮਪੀਟੀਸ਼ਨ ਸੀ ਫਿਰ ਸਾਨੂੰ ਡਰਾਇੰਗ ਦੀ ਡਰਾਇੰਗ ਦਾ ਕੁਛ ਬਣਾਉਣਾ ਸੀ